ਹੈਲੋ ਹਾਂ ਥੋੜ੍ਹੇ ਬਰੇਕ ਹੀ ਮਿਲੀ ਸੀ ਕੰਮ ਤੋਂ ਦੱਸ ਕੀ ਹਾਲ ਚਾਲ ਹਾਂ ਥੋੜ੍ਹਾ ਬੋਝ ਤਾਂ ਹੈਗਾ ਪਰ ਚੱਲਦਾ ਪਿਆ ਕੰਮ ਕਰ ਲਵਾਂਗੇ ਘਰ ਦੇ ਕੰਮ ਵੀ ਕਰ ਲਵਾਂਗੇ ਕੱਲ੍ਹ ਮੈਨੂੰ ਛੁੱਟੀ ਮਿਲ ਰਹੀ ਹੈ ਹਾਂਜੀ ਕਰ ਲਵਾਂਗੇ ਕੰਮ ਸਾਰੇ ਕੰਮ ਕਰ ਲਵਾਂਗੇ ਦੱਸੋ ਕੀ ਕੀ ਹੈਗਾ ਅੱਛਾ ਹਾਂ ਦੱਸੋ ਕਿਹੜੇ ਕਿਹੜੇ ਕੰਮ ਹੈ ਮੈਂ ਸਾਰੇ ਕੰਮ ਕਰਾ ਦਵਾਂਗਾ

ਠੀਕ ਆ ਆਹੋ ਮੈਂ ਦੇਖਿਆ ਸੀ ਪਿਛਲੀ ਵਾਰੀ ਲਾਈਟਾਂ ਨਹੀਂ ਸੀ ਚੱਲਦੀਆਂ ਨਾ ਅਸੀਂ ਕਰਾ ਲਵਾਂਗੇ ਪੇਂਟ ਠੀਕ ਹੈ ਪਲੰਬਰ ਦਾ ਕੀ ਕੰਮ ਆ ਅੱਛਾ ਠੀਕ ਆ ਇੱਕ ਤਾਂ ਬਿਜਲੀ ਵਾਲੇ ਦਾ ਕੰਮ ਹੋ ਗਿਆ ਪਲੰਬਰ ਵਾਲੇ ਦਾ ਵੀ ਕੰਮ ਹੋ ਗਿਆ ਅਤੇ ਹੋਰ ਕੁਛ ਰਹਿੰਦਾ ਤਾਂ ਦੱਸ ਦਿਉ ਸਾਰੇ ਹੁਣ ਅੱਛਾ ਨਵਾਂ ਬੈਡ ਬਣਾਉਣਾ ਹਾਂ ਠੀਕ ਹੈ ਫਿਰ ਰੰਗ ਵੀ ਕਰਾ ਦਿੰਦੇ ਉਹਦਾ ਕਮਰਾ ਦੱਸ

ਠੀਕ ਹੈ ਕੱਲ੍ਹ ਤਾਂ ਮੈਨੂੰ ਛੁੱਟੀ ਮਿਲ ਰਹੀ ਹੈ ਫਿਰ ਮੈਂ ਪਰਸੋਂ ਐਤਵਾਰ ਹੈਗਾ ਐਤਵਾਰ ਅਸੀਂ ਬਿਜਲੀ ਵਾਲਾ ਅਤੇ ਪਲੰਬਰ ਦਾ ਤਾਂ ਕੰਮ ਕਰਵਾ ਹੀ ਲੈਂਦੇ ਹਾਂ ਬਾਕੀ ਵੀ ਬਾਕੀ ਵੀ ਕਰਾ ਹੀ ਲਵਾਂਗੇ ਅਗਲੇ ਹਫਤੇ ਤੱਕ ਸਾਰੇ ਕੰਮ ਹੋ ਜਾਣਗੇ ਹਾਂ ਠੀਕ ਆ ਪੇਂਟ ਵੀ ਕਰਾ ਲੈਂਦੇ ਹਾਂ ਦੇਖ ਲਾ ਜੇ ਥੋੜ੍ਹਾ ਠੀਕ ਕਰਾਉਣਾ ਠੀਕ ਕਰਾ ਲੈਂਦੇ ਹਾਂ ਨਹੀਂ ਤਾਂ ਨਵਾਂ ਲੈਣਾ ਤਾਂ ਨਵਾਂ ਵੀ ਲੈ ਲਵਾਂਗੇ ਜਦ ਸਾਰੇ ਕੰਮ ਕਰਾਉਣੇ ਹੀ ਆ ਲੱਗੇ ਹੱਥ ਕਰਾ ਲਵਾਂਗੇ ਹਾਂ ਠੀਕ ਹੈ ਕੱਲ੍ਹ ਮੈਂ ਆ ਜਾਣਾ ਫਿਰ ਪਰਸੋਂ ਅਸੀਂ ਸਾਰੇ ਕੰਮ ਮਿਲਕੇ ਕਰ ਲਵਾਂਗੇ ਠੀਕ ਹੈ ਜੀ ਠੀਕ ਆ ਚਲੋ ਤੁਸੀਂ ਧਿਆਨ ਰੱਖੋ